ਜੀ ਹਾਂ ਮੈਨੂੰ ਕਈ ਵਾਰ ਕਲਾ ਪ੍ਰਦਰਸ਼ਨੀਆਂ ਅਤੇ ਐਕਸਪੋਜ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਹੈ ਇਹ ਮੇਰੇ ਲਈ ਇੱਕ ਮੌਕਾ ਹੈ ਜੋ ਵਿਭਿੰਨ ਕਲਾ ਰੂਪਾਂ ਅਤੇ ਕੈਟਾਗਰੀਆਂ ਨੂੰ ਦੇਖਣ ਅਤੇ ਸਮਝਣ ਲਈ ਹੈ ਇਸ ਦੌਰਾਨ ਮੈਂ ਵਧੇਰੇ ਕਲਾ ਦੇ ਸਰਗਰਮੀਆਂ ਨਾਲ ਮੁਲਾਕਾਤ ਕਰਦਾ ਹਾਂ ਅਤੇ ਉਨ੍ਹਾਂ ਦੇ ਹਰ ਕਲਾ ਦੇ ਪ੍ਰਕਾਰ ਨੂੰ ਸਮਝਣ ਦਾ ਪ੍ਰਿਆਸ ਕਰਦਾ ਹਾਂ ਇਹ ਕਲਾ ਪ੍ਰਦਸ਼ਨੀਆਂ ਮੇਰੇ ਲਈ ਇੱਕ ਸਿਖਰ ਦੇ ਤੌਰ 'ਤੇ ਸਾਂਝਾ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ ਹਨ ਤਾਂ ਕਿ ਹਰ ਲੋਕ ਇਹ ਅਨੁਭਵ ਕਰ ਸਕਣ ਮੈਂ ਵਧੇਰੇ ਕਲਾ ਦੇ ਰੂਪਾਂ ਜਿਵੇਂ ਕਿ ਚਿੱਤਰਕਲਾ ਸਥਾਪਿਤ ਕਲਾ ਕਲਾ ਅਤੇ ਗਤੀਵਿਧੀ ਕਲਾ ਦੇ ਚਿੱਤਰ ਮੈਂ ਖੋਜਦਾ ਹਾਂ ਮੈਂ ਹਰ ਇਕੱਠ 'ਤੇ ਮੈਂ ਕਲਾ ਨਾਲ ਜੁੜੇ ਸਵਾਲਾਂ ਪੁੱਛਦਾ ਹਾਂ ਸਰਗਮੀਆਂ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਨਾਲ ਮਿਲਦਾ ਹਾਂ ਇਸ ਪ੍ਰਕਾਰ ਨਾਲ ਅਨੁਭਵ ਮੇਰੇ ਲਈ ਅਦਭੁਤ ਹੈ ਕਿਉਂਕਿ ਇਹ ਮੇਰੇ ਹਰ ਦਖਲ ਨੂੰ ਵਧਾਉਂਦਾ ਹੈ ਅਤੇ ਹਰ ਵਾਰ ਨਵੀਨਤਾ ਅਤੇ ਸਾਹਿਤ ਪ੍ਰੇਰਨਾ ਦੀ ਖੋਜ ਵਿੱਚ ਮੁੱਖ ਰੂਪ ਨਾਲ ਹਿੱਸਾ ਲੈਣ ਦੇ ਇੰਤਜ਼ਾਮ ਕਰਦਾ ਹਾਂ ਜਦ ਮੈਂ ਕਿਸੇ ਐਕਸਪੋ ਵਿੱਚ ਜਾਂਦਾ ਹਾਂ ਤਾਂ ਹਮੇਸ਼ਾ ਨਵੀਨਤਾ ਤੱਕ ਨਹੀਂ ਅਤੇ ਸਮ੍ਰਿਧੀ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਮੈਨੂੰ ਉਹ ਮੌਕਾ ਮਿਲਦਾ ਹੈ ਜਦੋਂ ਮੈਂ ਅਗਲੇ ਪੀੜੀ ਦੀ ਕਲਾ ਨਾਲ ਮਿਲਦਾ ਹਾਂ ਅਤੇ ਅਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ